ਜਦੋਂ ਕਿ ਅਸੀਂ ਕਿਤੇ ਘੁੰਮਣ ਆਦਿ ਵਗੈਰਾ ਜਾਂਦੇ ਹਾਂ ਕਿਤੇ ਪਹਾੜਾਂ ਵਿੱਚ ਅਤੇ ਅਸੀਂ ਕਈ ਜਗ੍ਹਾ ਆਪਣਾ ਕੈਂਪ ਲਗਾਉਂਦੇ ਹਾਂ ਅਤੇ ਸਾਡਾ ਤਾਂ ਸਭ ਤੋਂ ਪਹਿਲਾਂ ਫਰਜ ਬਣਦਾ ਜਿੱਥੇ ਅਸੀਂ ਆਪਣਾ ਕੈਂਪ ਲਗਾਉਣਾ ਹੈ ਉੱਥੇ ਦੀ ਪਹਿਲੇ ਸਾਨੂੰ ਆਪਣੀ ਸਾਫ਼ ਸਫਾਈ ਦੇਖਣੀ ਚਾਹੀਦੀ ਹੈ ਅਗਰ ਉੱਥੇ ਕੂੜਾ ਹੋਏਗਾ ਪਹਿਲੇ ਉਸ ਨੂੰ ਸਾਫ਼ ਕੀਤਾ ਜਾਵੇਗਾ ਫਿਰ ਉਸ ਜਗ੍ਹਾ 'ਤੇ ਆਪਣੇ ਟੈਂਟ ਲਗਾਵਾਂਗੇ ਕਈ ਜਗ੍ਹਾ ਅਸੀਂ ਆਪਣਾ ਇੱਕ ਦਿਨ ਵਾਸਤੇ ਵੀ ਟੈਂਟ ਲਗਾਇਆ ਹੋਇਆ ਆਪਣਾ ਅਸੀਂ ਦੇਖਦੇ ਹਾਂ ਕਿ ਉੱਧਰ ਕੂੜਾ ਨਹੀਂ ਪਾਉਣਾ ਚਾਹੀਦਾ ਜਦੋਂ ਅਸੀਂ ਆਪਣਾ ਕੂੜਾ ਪਾਉਂਦੇ ਵੀ ਹਾਂ ਅਤੇ ਸਾਨੂੰ ਉਸ ਦਾ ਸਾਹਮਣਾ ਸਾਡਾ ਫਰਜ ਹੋਵੇਗਾ ਅਦਰ ਅਸੀਂ ਕਈ ਜਗ੍ਹਾ 'ਤੇ ਜਾਂਦੇ ਹਾਂ ਦੇਖਦੇ ਹਾਂ ਕਿ ਲੋਕ ਆਪਣੇ ਜਿੱਥੇ ਵੀ ਕੈਮਪਿੰਗ ਕਰਨ ਜਾਂਦੇ ਹਨ ਉੱਥੇ ਬਹੁਤ ਸਾਫ਼ ਸਫਾਈ ਰੱਖਦੇ ਹਨ ਸਭ ਤੋਂ ਪਹਿਲਾਂ ਸਾਡਾ ਫਰਜ ਇਹ ਵੀ ਬਣਦਾ ਹੈ ਕਿਤੇ ਨਾ ਕਿਤੇ ਸਾਨੂੰ ਆਪਣਾ ਆਪਣਾ ਕੈਂਪ ਲਗਾਇਆ ਹੋਇਆ ਤਾਂ ਸਾਨੂੰ ਜਦੋਂ ਅਸੀਂ ਸਾਰਾ ਕੰਮ ਖ਼ਤਮ ਹੋ ਜਾਏ ਸਾਨੂੰ ਵੀ ਆਪਣੀ ਜਗ੍ਹਾ ਦੀ ਸਾਫ਼ ਸਫਾਈ ਕਰ ਲੈਣੀ ਚਾਹੀਦੀ ਹੈ ਇਸੇ ਨਾਲ ਹੀ ਸਾਡਾ ਵਾਤਾਵਰਨ ਸ਼ੁੱਧ ਰਹੇਗਾ ਅਤੇ ਸਾਨੂੰ ਕਈ ਫਾਇਦਾ ਹੋਵੇਗਾ ਅਤੇ ਇਦਾਂ ਸਾਡੀ ਧਰਤੀ ਸਹੀ ਅਤੇ ਸਾਫ਼ ਸੁਥਰੀ ਰਹੇਗੀ ਅਤੇ ਨਾਲ ਦੁਨੀਆ 'ਚ ਸਭ ਤੋਂ ਜ਼ਿਆਦਾ ਫਾਇਦਾ ਸਾਨੂੰ ਹੋਵੇਗਾ